ਮੈਂ ਆਪਣੇ ਮਾਂ ਪਿਓ ਦੇ ਘਰ ਵੀ ਰੋਜ਼ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਜਾਈ ਦਾ ਸੀ ਔਰ ਬਹੁਤ ਚੰਗਾ ਲੱਗਦਾ ਸੀ ਉੱਥੇ ਜਾ ਕੇ ਪਾਠ ਸੁਣਨਾ ਅਤੇ ਸ਼ਬਦ ਕੀਰਤਨ ਸੁਣਨਾ ਅਤੇ ਉਵੇਂ ਹੀ ਮੈਂ ਜਾਰੀ ਇਸ ਕੰਮ ਨੂੰ ਜਾਰੀ ਰੱਖਦਿਆਂ ਹੋਇਆਂ ਹੁਣ ਵੀ ਅੱ ਅੱਜ ਕੱਲ੍ਹ ਮੈਂ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਂਦੀ ਹਾਂ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਦੀ ਹਾਂ